ਇੱਕ ਵਾਰ ਮੈਂ ਆਪਣੇ ਰੋਇਲ ਇੰਨਫੀਲਡ ਨੂੰ ਲੈ ਕੇ ਆਪਣੀ ਕੰਮ ਵਾਲੀ ਥਾਂ ਹਿਮਾਚਲ ਚਲਾ ਗਿਆ ਉੱਥੇ ਪਹਾੜੀ ਏਰੀਏ ਦੇ ਵਿੱਚ ਮੇਰੇ ਮੋਟਰਸਾਈਕਲ ਦਾ ਟਾਇਰ ਪੈਂਚਰ ਹੋ ਗਿਆ ਅੱਗੇ ਤਾਂ ਮੇਰੇ ਕੋਲ ਟਾਇਰ ਪੈਂਚਰ ਲਾਉਣ ਵਾਸਤੇ ਟੂਲ ਹੁੰਦੇ ਸਨ ਪਰ ਅਚਾਨਕ ਉਸ ਦਿਨ ਮੇਰੇ ਕੋਲ ਟਾਇਰ ਪੈਂਚਰ ਵਾਸਤੇ ਟੂਲ ਉ ਉਪਲਬਧ ਨਹੀਂ ਹੋਏ ਜਿਸ ਕਰਕੇ ਮੈਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਰੋਇਲ ਇੰਨਫੀਲਡ ਨੂੰ ਧੱਕਾ ਮਾਰਨਾ ਬਹੁਤ ਹੀ ਮੁਸ਼ਕਿਲ ਦਾ ਕੰਮ ਸੀ ਕੰਮ ਸੀ ਉਪਰ ਗਰਮੀ ਦਾ ਮੌਸਮ ਹੋਣ ਕਰਕੇ ਮੈਂ ਪਸੀਨੋਂ ਪਸੀਨੀ ਹੋਇਆ ਹੋਇਆ ਸੀ ਮੈਂ ਕਈਆਂ ਤੋਂ ਹੈਲਪ ਮੰਗੀ ਪਰ ਕਿਸੇ ਨੇ ਮੇਰੀ ਹੈਲਪ ਨਹੀਂ ਕੀਤੀ ਫਿਰ ਇੱਕ ਸਰਦਾਰ ਨੌਜਵਾਨ ਮੁੰਡੇ ਨੇ ਮੈਨੂੰ ਮੈਨੂੰ ਹੈਲਪ ਲਈ ਪੁੱਛਿਆ ਤਾਂ ਉਸ ਨੇ ਮੇਰੇ ਰੋਇਲ ਇੰਨਫੀਲਡ ਨੂੰ ਲੱਤ ਲਗਾ ਕੇ ਪੈਂਚਰ ਵਾਲੀ ਦੁਕਾਨ ਤੱਕ ਪਹੁੰਚਾਇਆ ਅਤੇ ਉਸ ਪੈਂਚਰ ਵਾਲੇ ਨੇ ਮੇਰੇ ਰੋਇਲ ਇੰਨਫੀਲਡ

ਟਿਊਬ ਨੂੰ ਪੈਂਚਰ ਲਗਾ ਕੇ ਰ ਰੈਡੀ ਕਰਕੇ ਮੈਨੂੰ ਆਪਣੀ ਮੰਜ਼ਿਲ ਵਾਸਤੇ ਵੱਲ ਰਵਾਨਾ ਕਰ ਦਿੱਤਾ